ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਭਾਅ ਜੀ ਗੱਲ ਮੇਰੀ ਗੱਲ ਮੀਸ਼ੋ ਵਾਲਿਆਂ ਨਾਲ ਹੋ ਰਹੀ ਹੈ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਮੈਂ ਨਾ ਤੁਹਾਨੂੰ ਔਡਰ ਲਾਇਆ ਸੀ ਪਹਿਲਾਂ ਤਾਂ ਔਡਰ ਮੇਰਾ ਬਹੁਤ ਵਧੀਆ ਰਿਹਾ ਮੈਂ ਇੱਕ ਕੁੜਤੀ ਮੰਗਵਾਈ ਸੀ ਉਹ ਤਾਂ ਬਹੁਤ ਵਧੀਆ ਆਈ ਹੈ ਲੇਕਿਨ ਮੈਂ ਹੁਣ ਇੱਕ ਹੈਡਫੋਨ ਮੰਗਵਾਏ ਸੀ ਉਹ ਨਹੀਂ ਸਹੀ ਆਏ ਭਾਅ ਜੀ ਹਾਂਜੀ ਭਾਅ ਜੀ ਇੱਕ ਤਾਂ ਉਹਦੀ ਤਾਰ ਸਾਰੀ ਕਰੈਕ ਹੋਈ ਹੋਈ ਹੈ ਥਾਂ ਥਾਂ ਤੋਂ ਤਾਰ ਉਹਦੀ ਕਰੈਕ ਹੋਈ ਹੋਈ ਹੈ ਅਤੇ ਜਿਹੜਾ ਹੈਡਫੋਨ ਹੈ ਕੰਨ 'ਚ ਲਗਾਉਣ ਵਾਲੇ ਇੱਕ ਦੀ ਤਾਂ ਰਬੜ ਹੀ ਨਹੀਂ ਗੀ ਹਾਂਜੀ ਅਤੇ ਆਵਾਜ਼ ਵੀ ਉਹਦੀ ਫਾੜ ਕੇ ਆਉਂਦੀ ਪਈ ਆ ਬਿਲਕੁਲ ਨਹੀਂ ਸਹੀ ਹੈਗੇ ਨਹੀਂ ਭਾਅ ਜੀ ਇਹੋ ਜਿਹੀ ਕੋਈ ਗੱਲ ਨਹੀਂ ਅਸੀਂ ਅੱਗੇ ਵੀ ਚਲੋ ਲਿਆਂਦੇ ਆ ਉਹ ਸਹੀ ਸੀ ਪਰ ਹੁਣ ਮੈਂ ਔਡਰ ਮੀਸ਼ੋ ਤੋਂ ਲਗਾ ਕੇ ਮੰਗਵਾਏ ਮੈਨੂੰ ਨਹੀਂ ਸਹੀ ਨਹੀਂ ਲੱਗੇ ਹਾਂਜੀ ਭਾਅ ਜੀ ਭਾਅ ਜੀ ਉਹਨਾਂ ਨੂੰ ਮੈਂ ਤੇ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਉਹਨਾਂ ਨੂੰ ਤੁਸੀਂ ਵਾਪਸ ਮੰਗਵਾ ਲਓ ਹਾਂਜੀ ਮੈਨੂੰ ਨਹੀਂ ਉਹ ਨਾ ਭਾਅ ਜੀ ਮੈਂ ਜਦੋਂ ਅੱਗੇ ਵੀ ਇੱਕ ਵਾਰੀ ਲਗਾਏ ਸੀ ਤੇ ਆਵਾਜ਼ ਉਹਦੀ ਬਿਲਕੁਲ ਹੈ ਫਾੜ ਕੇ ਆਉਂਦੀ ਵੀ ਮੈਂ ਦੁਬਾਰਾ ਵੀ ਟਰਾਈ ਕੀਤੀ ਫਿਰ ਵੀ ਇਹਦਾ ਉਹੀ ਹਾਲ ਸੀ ਹਾਂਜੀ ਭਾਅ ਜੀ ਹਾਂਜੀ ਮੇਰਾ ਆਡਰ ਨੰਬਰ ਹੈਗਾ ਸੀ ਅਠਾਈ ਪੱਚੀ ਹਾਂਜੀ ਹਾਂਜੀ ਭਾਅ ਜੀ ਹਾਂਜੀ ਸਾਡਾ ਡਰੈਸ ਹੈਗਾ ਹੈ ਤਰਨ ਤਾਰਨ ਰੋਡ ਜੈਮਨ ਵਾਲੀ ਗਲੀ ਹਾਂਜੀ ਕੋਟ ਪਾਲਾ ਸਿੰਘ ਹਾਂਜੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਮੇਰਾ ਔਡਰ ਦਾ ਕੁਛ ਨਾ ਕੁਛ ਤੁਸੀਂ ਕਰੋ ਹਾਂਜੀ ਵਾਪਸ ਲਿੱਤਾ ਜਾਵੇ ਹਾਂਜੀ ਭਾਅ ਜੀ ਠੀਕ ਹੈ ਧੰਨਵਾਦ ਭਾਅ ਜੀ ਧੰਨਵਾਦ